ਮੈਂ ਇੱਕ ਸਪੋਰਟਸਪਰਸਨ ਰਹੀ ਹਾਂ ਤਾਂ ਮੈਂ ਸਕੂਲ ਦੇ ਵਿੱਚ ਹੀ ਮੈਨੂੰ ਖੇਡਾਂ ਦੇ ਵਿੱਚ ਭਾਗ ਲੈਣ ਦਾ ਬਹੁਤ ਸ਼ੌਕ ਸੀ ਅਤੇ ਮੈਂ ਰਿਲੇਅ ਦੇ ਵਿੱਚ ਬਹੁਤ ਵਾਰ ਪਾਰਟੀਸਪੇਟ ਕੀਤਾ ਅਤੇ ਬਹੁਤ ਸਾਰੇ ਜਿਹੜੇ ਆ ਮੈਡਲਸ ਜਿੱਤੇ ਨੇ ਮੈਨੂੰ ਲੱਗਦਾ ਕਿ ਜਿਹੜਾ ਦੌੜਨ ਦੇ ਨਾਲ ਜਿਹੜਾ ਬੰਦੇ ਦਾ ਸਰੀਰ ਆ ਉਹ ਬਹੁਤ ਤੰਦਰੁਸਤ ਰਹਿੰਦਾ ਬੰਦਾ ਫਿੱਟ ਰਹਿੰਦਾ ਅਤੇ ਜਿਹੜੀਆਂ ਉਹਦੀਆਂ ਸਾਰੀਆਂ ਇੰਦਰੀਆਂ ਹੁੰਦੀਆਂ ਅਤੇ ਉਹਦਾ ਮਾਸਪੇਸ਼ੀਆਂ ਹੁੰਦੀਆਂ ਉਹ ਮਜ਼ਬੂਤ ਹੁੰਦੀਆਂ